ਭੰਗੜਾ ਐਰੋਬਿਕਸ ਹੋਰ ਕਸਰਤ ਵਿਕਲਪਾਂ ਦੇ ਮੁਕਾਬਲੇ ਵਧੇਰੇ ਦਿਲਚਸਪ ਅਤੇ ਮਜ਼ੇਦਾਰ ਇਸ ਕਰਕੇ ਹੈ ਕਿਉਂਕਿ ਇਹ ਸਿਰਫ ਇੱਕ ਵਰਕਆਊਟ ਨਹੀਂ ਹੈ ਸਗੋਂ ਇਹ ਪੂਰਾ ਸੰਗੀਤਕ ਅਤੇ ਸੱਭਿਆਚਾਰਕ ਤਜਰਬਾ ਵੀ ਹੈ ਇੱਥੇ ਕੁਝ ਮੁੱਖ ਕਾਰਨ ਹਨ ਜੋ ਭੰਗੜਾ ਐਰੋਬਿਕਸ ਨੂੰ ਹੋਰ ਰਿਵਾਇਤੀ ਵਰਕਆਊਟਾਂ ਤੋਂ ਵਧੇਰੇ ਆਕਰਸ਼ਕ ਬਣਾਉਂਦਾ ਹੈ ਪਹਿਲਾ ਜੋਸ਼ ਅਤੇ ਉਤਸਾਹ ਭੰਗੜਾ ਦੀ ਉਤਸਾਹ ਭਰੀ ਢੋਲ ਦੀ ਧੁਨ ਜਿਸ ਨੇ ਨੱਚਣ ਨਾਲ ਮਾਨਸਿਕ ਅਤੇ ਸਰੀਰਕ ਤੌਰ 'ਤੇ ਜੋਸ਼ ਅਤੇ ਉਤਸਾਹ ਬਣਿਆ ਰਹਿੰਦਾ ਹੈ ਦੂਸਰਾ ਪੂਰੇ ਸਰੀਰ ਦੀ ਕਸਰਤ ਭੰਗੜਾ ਕਾਰਡੀਓ ਸਟਰੈਂਥ ਅਤੇ ਐਂਡਿਊਰੈਂਸ ਦਾ ਮਿਲਾਪ ਹੈ ਤੀਸਰਾ ਬੋਲ ਨਹੀਂ ਹੁੰਦੇ ਜਿਵੇਂ ਕਿ ਟਰੈਡਮਿਲ ਜਾਂ ਰਿਵਾਇਤੀ ਜਿਮ ਵਰਕਆਊਟ ਵਿੱਚ ਬਾਰ ਬਾਰ ਉਹੀ ਚੀਜ਼ ਕਰਨੀ ਪੈਂਦੀ ਹੈ ਜਿਸ ਕਰਕੇ ਲੋਕ ਉਕਤਾ ਜਾਂਦੇ ਹਨ ਚੌਥਾ ਕੈਲੋਰੀਜ ਜਲਾਉਣ ਵਿੱਚ ਅਸਰਦਾਰ ਇਹ ਵਜ਼ਨ ਘਟਾਉਣ ਫਿਟਨੈਸ ਅਤੇ ਸਟੈਮਿਨਾ ਵਧਾਉਣ ਵਿੱਚ ਬਹੁਤ ਵਧੀਆ ਹੈ ਮਾਨਸਿਕ ਤੰਦਰੁਸਤੀ ਵੀ ਭੰਗੜੇ ਦੇ ਨਾਲ ਬਹੁਤ ਵਧੀਆ ਰਹਿੰਦੀ ਹੈ ਇਹ ਕੁਝ ਕਾਰਨ ਹਨ ਜਿਹਨਾਂ ਕਰਕੇ ਭੰਗੜਾ ਐਰੋਬਿਕਸ ਹੋਰ ਕਸਰਤ ਵਿਕਲਪਾਂ ਦੇ ਮੁਕਾਬਲੇ ਇੰਨਾਂ ਦਿਲਚਸਪ ਹੈ